ਚਾਰ ਅਗਸਤ ਉੱਨੀ ਸੋ ਛਿਆਨਵੇਂ ਚੌਵੀ ਜੁਲਾਈ ਦੋ ਹਜ਼ਾਰ ਇੱਕ ਪੰਜ ਜਨਵਰੀ ਦੋ ਹਜ਼ਾਰ ਤਿੰਨ ਬਾਰ੍ਹਾਂ ਮਾਰਚ ਦੋ ਹਜ਼ਾਰ ਚਾਰ ਪੰਜ ਅਪ੍ਰੈਲ ਦੋ ਹਜ਼ਾਰ ਇੱਕੀ